ਹੈਲੋ ਹਾਂਜੀ ਭਾਅ ਜੀ ਪ੍ਰੋ ਬੋਨੋ ਕਲੱਬ ਤੋਂ ਬੋਲਦੇ ਹੋ ਹਾਂਜੀ ਭਾਅ ਜੀ ਮੈਂ ਨਾ ਪਤਾ ਕਰਾਉਣਾ ਸੀਗਾ ਜੇਕਰ ਮੈਨੂੰ ਨਾ ਬੱਚੇ ਹੈਗੇ ਆ ਦੋ ਤਿੰਨ ਠੀਕ ਆ ਓ ਸੌਰੀ ਤਿੰਨ ਬੱਚੇ ਨੇ ਐਕਚੁਲੀ ਨਾ ਉਹਨਾਂ ਦਾ ਤੁਸੀਂ ਮੰਨੋ ਨਾ ਇੰਟਰਸਟ ਹੈ ਨਹੀਂ ਕਿਸੇ ਚੀਜ਼ 'ਤੇ ਟੀ ਵੀ 'ਚ ਬੜੇ ਰਹਿੰਦੇ ਨੇ ਤੁਹਾਡੀ ਕਿਹੜੀ ਕਿਹੜੀ ਐਕਟੀਵਿਟੀਸ ਹੈਗੀਆਂ ਨੇ ਪਹਿਲਾਂ ਤਾਂ ਆਹ ਦੱਸੋ ਮੈਨੂੰ ਕਲੱਬ 'ਚ ਕੀ ਕੀ ਕਰਾਉਂਦੇ ਹੋ

ਓਕੇ ਤੇ ਨਾਲੇ ਮਤਲਬ ਕੀ ਕੀ ਫੀਸ ਕਿਸ ਅਕੋਰਡਿੰਗ ਲੈਂਦੇ ਕਿਉਂਕਿ ਮੇਰੇ ਨਾਲ ਹਲੇ ਇੱਕ ਕੁੜੀ ਹੈਗੀ ਹੈ ਤਿੰਨ ਕੁ ਸਾਲ ਦੀ ਅਤੇ ਉਹਨੂੰ ਵੀ ਮੈਂ ਸੋਚਦਾ ਪਿਆ ਕਿ ਸਟਾਰਟਿੰਗ 'ਤੇ ਹੀ ਨਾ ਥੋੜ੍ਹਾ ਹੈਂ ਹੈਂਡਰਾਈਟਿੰਗ ਪਲੇਅ ਵੇ ਟਾਈਪ ਦਾ ਕੁਛ ਹੈਗਾ ਵਾ ਤੁਹਾਡਾ ਹੋਰ ਠੀਕ ਆ ਫਿਰ ਹੋਰ ਹੀ ਵਧੀਆ ਯਾਰ ਹੋਰ ਕੀ ਚਾਹੀਦਾ ਬਾਕੀ ਤਾਂ ਹੋਰ ਉਸ ਤੋਂ ਵੱਡੇ ਹੀ ਹੈਗੇ ਆ ਥੋੜ੍ਹੇ ਹਾਂਜੀ ਅਤੇ ਐਕਚੁਲੀ ਨਾ ਮੈਨੂੰ ਇੱਕ ਮੇਨ ਗੱਲ ਆਹ ਪਤਾ ਕਰਨੀ ਸੀਗੀ ਜਿੱਦਾਂ ਹੁਣ ਹੈਗੇ ਆ ਕਿ ਅਗਰ ਮੈਂ ਵੀ ਕਰਨਾ ਚਾਹਵਾਂ ਅਤੇ ਮੇਰੇ ਵਾਈਫ ਜੇਕਰ ਕਰਨਾ ਚਾਹਵੇ ਤਾਂ ਮਤਲਬ ਕੀ ਕੀ ਹੈਗਾ ਵਾ ਅਤੇ ਨਾਲੇ ਸਰ ਕੰਪਟੀਸ਼ਨ ਵਗੈਰਾ ਕੁਝ ਹੁੰਦਾ ਤੁਹਾਡਾ ਉੱਧਰ ਓਕੇ ਨਾਲੇ ਫੀਸ ਸਟਰਕਚਰ ਕੀ ਕੁਝ ਹੈਗਾ ਵਾ ਜੇਕਰ ਆਪਾਂ ਤਿੰਨ ਚਾਰ ਲੋਕ ਇਕੱਠੇ ਹੋ ਕੇ ਆਉਂਦੇ ਹਾਂ ਨਾ ਜੇਕਰ ਹੁਣ ਮਹੱਲਾ ਮੁਹੱਲਾ ਇੱਕ ਨਾਲੇ ਜੇਕਰ ਮੈਨੂੰ ਹੁਣ ਕਿਉਂਕਿ ਬੱਚਿਆ ਦਾ ਹੈਗਾ ਵਾ ਹੈ ਨਾ ਅਤੇ ਤਾਂ ਉਹਦੀ ਕਿਉਂਕਿ ਸਕੂਲ ਵਗੈਰਾ ਵੀ ਜਾਂਦੇ ਨੇ ਤਾਂ ਉਹਦੀ ਕੀ ਟਾਈਮਿੰਗ ਉਹਨਾਂ ਦਾ ਕੀ ਹੈਗਾ ਕਿਵੇਂ ਐਡਜਸਟ ਕਰਾਂਗੇ ਮੇਰੇ ਜੀ ਤਿੰਨ ਵਜੇ ਤੱਕ ਵੈਸੇ ਆਉਂਦੇ ਹਾਂ ਛੁੱਟੀ ਢਾਈ ਵਜੇ ਹੁੰਦੀ ਹੈ ਤਿੰਨ ਵਜੇ ਤੱਕ ਆ ਜਾਂਦੇ ਆ ਸਰ

ਹਾਂਜੀ ਹਾਂਜੀ ਵੈਸੇ ਤਾਂ ਹੋ ਜਾਂਦੇ ਨੇ ਬਟ ਫਿਰ ਵੀ ਨਾ ਉਹ ਕਿਉਂਕਿ ਧੁੱਪ ਤੁਹਾਨੂੰ ਪਤਾ ਹੀ ਹੈ ਅਤੇ ਗਰਮੀ ਵਾਹਲੀ ਪੈਂਦੀ ਆ ਹੂੰ

ਅਤੇ ਨਾਲੇ ਫੀਸ ਸਟਰਕਚਰ ਦਾ ਤਾਂ ਤੁਸੀਂ ਕਹਿ ਹੀ ਦਿੱਤਾ ਕਿ ਮਤਲਬ ਲੈੱਸ ਕਿੰਨਾ ਕੁ ਕਰ ਦੂੰਗੇ ਓਕੇ ਓਕੇ ਨਾਲੇ ਸਰਟੀਫਿਕੇਟ ਦੀ ਹਾਲੇ ਤੁਸੀਂ ਗੱਲ ਕੀਤੀ ਉਹ ਸਰਟੀਫਿਕੇਟ ਕੀ ਨੈਸ਼ਨਲ ਕੀ ਖੇਡ ਲੈਵਲ ਕਿਸ ਲੈਵਲ ਦਾ ਕਰਾਉਂਦੇ ਹੋ ਜੀ

ਮਤਲਬ ਬੱਚਿਆਂ ਦੇ ਕੰਮ ਆਵੇ ਨਾ ਇਹ ਵੀ ਨਾ ਹੋਵੇ ਕਿ ਸਰਟੀਫਿਕੇਟ ਪਏ ਰਹਿਣ ਸਾਈਡ 'ਤੇ ਉਹ ਵੀ ਚੰਗਾ ਨਹੀਂ ਹੁੰਦਾ ਨਾ ਤੁਸੀਂ ਜਾਣਦੇ ਹੀ ਹੋ ਜਿਵੇਂ ਕਿ ਆਪਾਂ ਹੁਣ ਲਗਾਉਂਦੇ ਪਏ ਹਾਂ ਪੈਸੇ ਪੂਸੇ ਤਾਂ ਅੱਗੇ ਬੱਚਿਆਂ ਦੇ ਕੰਮ ਆਉਣ ਜੀ ਚਲੋ ਫਿਰ ਕੱਦੋਂ ਤੱਕ ਤੁਸੀਂ ਮਿਲਦੇ ਹੋ ਆਫਿਸ 'ਚ ਜੇਕਰ ਆਪਾਂ ਆਉਂਦੇ ਹਾਂ ਤਾਂ ਚਲੋ ਠੀਕ ਆ ਫਿਰ ਮੈਂ ਦੇਖਦਾ ਜੇਕਰ ਮੇਰੀ ਵਾਈਫ ਕਹਿੰਦੀ ਹੈ ਨਾ ਅਲਾਊਡ ਕਰਦੀ ਆ ਹਾਂ ਆਪਾਂ ਦੇਖਦੇ ਹਾਂ ਪਰਸੋਂ ਨੂੰ ਮੈਂ ਕਰਦਾ ਟਰਾਈ ਆਉਣ ਦਾ ਸਵੇਰੇ ਦਸ ਕੁ ਵਜੇ ਤੱਕ ਆ ਜਾਂਦੇ ਹੋ ਨਾ ਦਸ ਕੁ ਵਜੇ ਤੱਕ ਤਾਂ ਮਿਲਜੂੰਗੇ ਚਲੋ ਠੀਕ ਹੈ ਭਾਅ ਜੀ ਥੈਂਕ ਯੂ ਤੁਹਾਡਾ ਇੰਨਾ ਇੰਨਾ ਵਧੀਆ ਬਾਕੀ ਆਪਾਂ ਮਿਲ ਕੇ ਗੱਲ ਕਰਦੇ ਹਾਂ ਠੀਕ ਆ ਅਤੇ ਮੈਂ ਹੋਰ ਕੋਸ਼ਿਸ਼ ਕਰੂੰਗਾ ਜਿੰਨੇ ਕੁ ਹੋਰ ਨਾਲ ਦੇ ਹੋ ਜਾਣ ਬੰਦੇ ਵਧੀਆ ਹੀ ਹੈ ਜੇ ਹੈ ਨਾ ਤੁਹਾਨੂੰ ਵੀ ਵਧੀਆ ਹੋਵੇਗਾ ਸਾਡਾ ਵੀ ਸਾਥ ਹੋ ਜਾਊਗਾ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ